ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਹੈ ਮੈਂ ਹਾਲ ਹੀ ਹਾਲ ਹੀ ਇੱਕ ਇੱਕ ਘੰਟੇ ਪਹਿਲਾਂ ਪ ਸਵੀਗੀ ਤੋਂ ਇੱਕ ਭੋਜਨ ਦੀ ਡਿਲੀਵਰੀ ਮੰਗਵਾਈ ਸੀ ਜਿਸ ਵਿੱਚ ਦੋ ਸਪਰਿੰਗ ਰੋਲ ਪੰਜ ਬਰਗਰ ਦੋ ਲਾਰਜ਼ ਸਾਈਜ ਪੀਜ਼ਾ ਔਡਰ ਕੀਤਾ ਗਿਆ ਸੀ ਅਤੇ ਇਹ ਆਡਰ ਜਿਹੜਾ ਹੈ ਇਹ ਇਸ ਨਾਲ ਮੈਨੂੰ ਬਹੁਤ ਅ ਖੁਸ਼ੀ ਨਹੀਂ ਹੋਈ ਹੈ ਇਹ ਗਲਤ ਔਡਰ ਆਇਆ ਹੈ ਇਸ ਵਿੱਚ ਜੋ ਸਮਾਨ ਸੀ ਉਹ ਖ਼ਰਾਬ ਲੱਗ ਰਿਹਾ ਹੈ ਇਸਦਾ ਪੈਕਟ ਵੀ ਫਟਿਆ ਹੋਇਆ ਹੈ ਜਿਸ ਨਾਲ ਮੇਰੇ ਕੁਲੀਗ ਬਿਲਕੁਲ ਵੀ ਸੰਤੁਸ਼ਟ ਨਹੀਂ ਹਨ ਉਹ ਕਹਿ ਰਹੇ ਹਨ ਕਿ ਇਹ ਗਲਤ ਔਡਰ ਆ ਚੁੱਕਿਆ ਹੈ ਇਸ ਲਈ ਮੈਨੂੰ ਇਹਦੀ ਇਸ ਦੀ ਵਾਪਸ ਕਰਨ ਦੀ ਪੋਲਿਸੀ ਬਾਰੇ ਵਾਪਸ ਕਰਨਾ ਸੰਭਵ ਹੈ ਜਾਂ ਨਹੀਂ ਇਹ ਦੱਸਿਆ ਜਾਵੇ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਮੈਂ ਇਹ ਔਡਰ ਵਾਪਸ ਕਰਾਂ ਜਾਂ ਫਿਰ ਇਸਨੂੰ ਰਿਪਲੇਸ ਕਰਵਾਵਾਂ ਮੈਨੂੰ ਜਲਦ ਤੋ ਜਲਦ ਇਸ ਬਾਰੇ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਮੈਂ ਇਹ ਜਾਣ ਸਕਦਾ ਹਾਂ ਕਿ ਮੈਂ ਕਿਸ ਤਰ੍ਹਾਂ ਮੇਰਾ ਔਡਰ ਵਾਪਸ ਹੋ ਸਕਦਾ ਹੈ ਧੰਨਵਾਦ